ਮੇਰਾ ਨਾਂ ਰਾਘਵ ਹੈ ਮੈਂ ਪਠਾਨਕੋਟ ਸ਼ਹਿਰ ਦਾ ਰਹਿਣ ਵਾਲਾ ਹਾਂ ਸਾਡੇ ਪਠਾਨਕੋਟ ਵਿੱਚ ਜ਼ਿਆਦਾਤਰ ਲੋਕੀ ਪੰਜਾਬੀ ਹੀ ਬੋਲਦੇ ਹਨ ਪੰਜਾਬੀ ਸਾਡੀ ਮਾਂ ਬੋਲੀ ਹੈ ਅਤੇ ਮੈਂ ਪੰਜਾਬ ਦਾ ਰਹਿਣ ਵਾਲਾ ਹਾਂ ਇਸ ਕਰਕੇ ਮੈਂ ਵੀ ਪੰਜਾਬੀ ਹੀ ਬੋਲਦਾ ਹਾਂ ਸਾਡੇ ਸਕੂਲਾਂ ਵਿੱਚ ਸ਼ੁਰੂ ਤਾਂ ਸ਼ੁਰੂ ਤੋਂ ਹੀ ਪੰਜਾਬੀ ਨੂੰ ਲਾਜ਼ਮੀ ਭਾਸ਼ਾ ਬਣਾਈ ਗਈ ਹੈ ਪੰਜਾਬੀ ਸ ਸਾਡੇ ਸੱਭਿਆਚਾਰ ਨੂੰ ਦਰਸਾਉਂਦੀ ਹੈ ਮੈਂ ਤਾਂ ਇਹੀ ਕਹਾਂਗਾ ਕਿ ਸਾਡੇ ਸਾਰੇ ਪੰਜਾਬੀਆਂ ਨੂੰ ਪੰਜਾਬੀ ਆਉਣੀ ਚਾਹੀਦੀ ਹੈ ਹੁਣ ਸਕੂਲ ਵਾਲੇ ਪਹਿਲੀ ਤੋਂ ਲੈ ਕੇ ਦਸਵੀਂ ਗਿਆਰ੍ਹਵੀਂ ਬਾਰ੍ਹਵੀਂ ਸਾਰੀ ਜਮਾਤਾਂ ਨੂੰ ਪੰਜਾਬੀ ਲਾਜ਼ਮੀ ਰੱਖਦੀ ਹੈ ਹੁਣ ਤਾਂ ਪੰਜਾਬੀ ਸਾਡੇ ਬਾਹਰਲੇ ਦੇਸ਼ਾਂ 'ਚ ਵੀ ਬੋਲੀ ਜਾ ਰਹੀ ਹੈ ਸਾਡੇ ਰੋਡਾਂ 'ਤੇ ਜਿਹੜੇ ਸਾਈਨ ਬਣੇ ਹੁੰਦੇ ਹਨ ਉਹ ਕਈ ਸਾਈਨ ਪੰਜਾਬੀ ਵਿੱਚ ਵੀ ਲਿਖੇ ਜਾਂਦੇ ਹਨ ਪੰਜਾਬੀ ਭਾਸ਼ਾ ਬਹੁਤ ਸਰਲ ਹੈ ਅਤੇ ਇਸ ਇਹ ਛੇਤੀ ਸਮਝ ਵੀ ਆ ਜਾਂਦੀ ਹੈ ਪੰਜਾਬੀ ਪੰਜਾਬੀ ਜਿਹੜੀ ਹੈਗੀ ਹੈ ਪੰਜਾਬੀ ਸਾਡੀ ਮਾਂ ਬੋਲੀ ਹੈ ਇਹ ਸਾਡੇ ਗੁਰੂਆਂ ਦੇ ਦੁਆਰਾ ਬੋਲੀ ਬਣਾਈ ਗਈ ਹੈ ਇਹ ਸਾਨੂੰ ਉਹ ਕਈ ਚਿਰਾਂ ਤੋਂ ਚਲੀ ਆ ਰਹੀ ਹੈ ਮੈਂ ਤਾਂ ਇਹੀ ਕਵਾਂਗਾ ਕਿ ਸਾਰੇ ਪੰਜਾਬੀਆਂ ਨੂੰ ਪੰਜਾਬੀ ਹੀ ਬੋਲਣੀ ਚਾਹੀਦੀ ਹੈ ਅੱਜ ਕੱਲ੍ਹ ਕਈ ਦੂਜੀਆਂ ਭਾਸ਼ਾ ਜਿੱਦਾਂ ਬਾਹਰਲੀਆਂ ਅੰਗਰੇਜ਼ੀ ਵੀ ਸਿਖਾਈ ਜਾ ਰਹੀ ਹੈ ਪਰ ਪੰਜਾਬੀ ਅੱਜ ਕੱਲ੍ਹ ਪੰਜਾਬ ਵਿੱਚ ਲਾਜ਼ਮੀ ਰੱਖੀ ਹੈ ਪੰਜਾਬ ਵਿੱਚ ਕਈ ਟੈਸਟ ਦੇ ਨੇ ਜਿਹੜੇ ਦਿੰਦੇ ਹਾਂ ਉਹ ਪੰਜਾਬੀ ਵਿੱਚ ਹੀ ਦਿੱਤੇ ਜਾਂਦੇ ਹਨ